ਹਾਂਜੀ ਮੈਂ ਮਤਲਬ ਕਿ ਹਮੇਸ਼ਾ ਹੀ ਖਾਣੇ ਵਾਸ ਮੈਨ ਮੈਨੂੰ ਮਤਲਬ ਖਾਣਾ ਬਹੁਤ ਜ਼ਿਆਦਾ ਪਸੰਦ ਹੈਗਾ ਹੈ ਠੀਕ ਹੈ ਆਈ ਐਮ ਫਾਊਂਡ ਔਫ ਫੂਡ ਸੋ ਮਤਲਬ ਕਿ ਮੈਂ ਅਲੱਗ ਅਲੱਗ ਸ਼ਹਿਰਾਂ ਵਿੱਚ ਜਾ ਕੇ ਉੱਥੋਂ ਦਾ ਮਤਲਬ ਫੇਮਸ ਜਿਹੜਾ ਕੋਈ ਵੀ ਫੂਡ ਹੁੰਦਾ ਮੈਂ ਉਹ ਖਾਣਾ ਟਰਾਈ ਕਰਨਾ ਬਹੁਤ ਜ਼ਿਆਦਾ ਮਤਲਬ ਮੈਨੂੰ ਵਧੀਆ ਲੱਗਦਾ ਮੈਨੂੰ ਪਸੰਦ ਵੀ ਹੈਗਾ ਜਿਵੇਂ ਕਿ ਅੰਮ੍ਰਿਤਸਰ ਠੀਕ ਆ ਸਭ ਤੋਂ ਪਹਿਲਾਂ ਆਪਾਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਅੰਮ੍ਰਿਤਸਰ ਅੰਮ੍ਰਿਤਸਰ ਦੀ ਮਤਲਬ ਛੋਲੇ ਭਟੂਰੇ ਕੁਲਚੇ ਰੱਬੜੀ ਰਸ ਮਲਾਈ ਮਤਲਬ ਕਿ ਬਹੁਤ ਹੀ ਜ਼ਿਆਦਾ ਫੇਮਸ ਹੈਗੀ ਆ ਜਿਹੜੇ ਅੱਜ ਕੱਲ੍ਹ ਦੇ ਲੋਕ ਹੈਗੇ ਆ ਉਹ ਦੂਰੋਂ ਮਤਲਵ ਸਪੈਸ਼ਲੀ ਜਿਹੜੇ ਫੋਰਨਰਸ ਹੁੰਦੇ ਆ ਜਾਂ ਜਾਂ ਮਤਲਬ ਦੂਰ ਦੂਰ ਦੇ ਲੋਕ ਹੁੰਦੇ ਆ ਉਹ ਸਪੈਸ਼ਲੀ ਮਤਲਬ ਕਿ ਅੰਮ੍ਰਿਤਸਰ ਕਈ ਵਾਰੀ ਉਚੇਚਾ ਆਪਾਂ ਛੋਲੇ ਭਟੂਰੇ ਅਤੇ ਕੁਲਚੇ ਵਾਸਤੇ ਆਉਂਦੇ ਹਾਂ ਠੀਕ ਆ ਅੰਮ੍ਰਿਤਸਰ ਦਾ ਮਤਲਬ ਛੋਲੇ ਭਟੂਰੇ ਕੁਲਚੇ ਇੰਨੇ ਹੀ ਜ਼ਿਆਦਾ ਫੇਮਸ ਆ ਅਤੇ ਉਹ ਬਹੁਤ ਜ਼ਿਆਦਾ ਸਵਾਦ ਵੀ ਹੁੰਦੇ ਆ ਉੱਥੋਂ ਦਾ ਸਵਾਦ ਆਪਾਂ ਨੂੰ ਕਿਤੇ ਵੀ ਨਹੀਂ ਮਿਲਦਾ ਮਤਲਬ ਕਿਸੇ ਦੇ ਹੱਥ ਦਾ ਉਵੇਂ ਦਾ ਸਵਾਦ ਨਹੀਂ ਹੁੰਦਾ ਮੈਂ ਛੋਲੇ ਭਟੂਰੇ ਖਾਣ ਲਈ ਉਚੇਚਾ ਅੰਮ੍ਰਿਤਸਰ ਜਾਂਦੀ ਹਾਂ ਠੀਕ ਆ ਹਫ਼ਤੇ ਵਿੱਚ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਉੱਥੋਂ ਦੇ ਛੋਲੇ ਭਟੂਰੇ ਕੁਲਚੇ ਅਤੇ ਸਪੈ ਖਾਓ ਉੱਥੋਂ ਖਾਣ ਤੋਂ ਬਾਅਦ ਰਬੜੀ ਓ ਮਾਈ ਗੋਡ ਦੈਟ ਵਾਜ ਸੋ ਅਮੈਜ਼ਿੰਗ ਮਤਲਵ ਕਿ ਇੰਨੀ ਜ਼ਿਆਦਾ ਸਵਾਦ ਹੁੰਦੀ ਹੈ ਅਤੇ ਖਾਣਾ ਮਤਲਬ ਖਾਣਾ ਖਾਣ ਖਾਣਾ ਖਾਣਾ ਮੈਨੂੰ ਬਹੁਤ ਜ਼ਿਆਦਾ ਪਸੰਦ ਹੈਗਾ ਹੈ ਉਹਦੇ ਨਾਲ ਮਤਲਬ ਮੈਨੂੰ ਬੜੀ ਜ਼ਿਆਦਾ ਮਤਲਬ ਖੁਸ਼ੀ ਹੁੰਦੀ ਆ ਅਲੱਗ ਅਲੱਗ ਤਰ੍ਹਾਂ ਦਾ ਫੂਡ ਟੇਸਟ ਕਰਨਾ ਕਿਉਂਕਿ ਮੈਨੂੰ ਮੈਨੂੰ ਫੂਡ ਬਣਾਉਣਾ ਬਹੁਤ ਜ਼ਿਆਦਾ ਪਸੰਦ ਹੈ ਠੀਕ ਹੈ ਸੋ ਮਤਲਬ ਕਿ ਮੈਂ ਅਲੱਗ ਅਲੱਗ ਫੂਡ ਦੀ ਮਤਲਬ ਟੇਸਟ ਕਰਦੀ ਰਹਿਦੀ ਹਾਂ ਉਹਨੂੰ ਸਿੱਖਦੀ ਹਾਂ ਫਿਰ ਉਹਨੂੰ ਮੈਂ ਬਣਾਉਂਦੀ ਹਾਂ ਅਤੇ ਅੰਮ੍ਰਿਤਸਰ ਦਾ ਪਰ ਜਿਹੜੇ ਉਹ ਛੋਲੇ ਭਟੂਰੇ ਦਾ ਸਵਾਦ ਹੈਗਾ ਨਾ ਉਹ ਕਿਤੇ ਵੀ ਨਹੀਂ ਹੈਗਾ ਅਤੇ ਮੈਨੂੰ ਨਾ ਹੀ ਹਜੇ ਤੱਕ ਉੱਦਾਂ ਦਾ ਫੂਡ ਕਿਤੇ ਤੋਂ ਮਿਲਿਆ ਅਤੇ ਨਾ ਹੀ ਮਤਲਬ ਕਿ ਉੱਦਾਂ ਦਾ ਸਵਾਦ ਟੇਸਟ ਮੈਂ ਬਣਾ ਪਾਉਂਦੀ ਆ ਠੀਕ ਆ ਅਗਰ ਤੁਸੀਂ ਵੀ ਸਾਰੇ ਜਣੇ ਕਿਤੇ ਅੰਮ੍ਰਿਤਸਰ ਜਾਓਗੇ ਤਾਂ ਤੁਸੀਂ ਛੋਲੇ ਭਟੂਰੇ ਕੁਲਚੇ ਬਹੁਤ ਜਿਆਦਾ ਮਤਲਬ ਕਿ ਉੱਥੇ ਵਧੀਆ ਤਰਾਂ ਮਤਲਬ ਇੱਕ ਆਪਾਂ ਨੂੰ ਸਰਵਿੰਗ ਸੈਂਸ ਅਤੇ ਬਣਾਉਣ ਦਾ ਤਰੀਕਾ ਬੜਾ ਹੀ ਜ਼ਿਆਦਾ ਵਧੀਆ ਹੁੰਦਾ ਅਤੇ ਉਹ ਬ ਇੰਨੇ ਜ਼ਿਆਦਾ ਚੀਫ ਵੀ ਹੁੰਦੇ ਆ ਤੀਹ ਰੁਪਏ ਦੀ ਪਲੇਟ ਹੁੰਦੀ ਆ ਠੀਕ ਆ ਉਹ ਆਪਾਂ ਨੂੰ ਆਪਾਂ ਜਦੋਂ ਉਹ ਖਾਂਦੇ ਹਾਂ ਆਪਾਂ ਨੂੰ ਮਤਲਬ ਕਿ ਅਲੱਗ ਹੀ ਸਵਾਦ ਆ ਜਾਂਦਾ ਪਤਾ ਲੱਗ ਜਾਂਦਾ ਹੈ ਕਿ ਹਾਂ ਯਾਰ ਅੰਮ੍ਰਿਤਸਰ ਆਏ ਹਾਂ ਤਾਂ ਸਿਰਫ਼ ਛੋਲੇ ਭਟੂਰੇ ਵਾਸਤੇ ਹੀ ਅਤੇ ਮੇਰੀ ਫੈਮਲੀ ਜਦੋਂ ਵੀ ਆਪਾਂ ਕੋਈ ਪਲੈਨ ਬਣਾਉਂਦੇ ਹਾਂ ਨਾ ਵੀਕ ਵਿੱਚ ਅਤੇ ਮੈਂ ਸਪੈਸ਼ਲੀ ਉਹਨਾਂ ਦੀ ਦੁਕਾਨ 'ਤੇ ਜਾਂਦੀ ਹਾਂ ਬਿਟੂ ਦੀ ਦੁਕਾਨ 'ਤੇ ਉਹਨਾਂ ਦੀ ਦੁਕਾਨ 'ਤੇ ਬਹੁਤ ਹੀ ਜ਼ਿਆਦਾ ਮਤਲਬ ਭੀੜ ਹੁੰਦੀ ਹੈ ਬੜੇ ਲੋਕ ਹੁੰਦੇ ਆ ਅਤੇ ਸੰਡੇ ਨੂੰ ਤਾਂ ਮੇਰਾ ਪੱਕਾ ਹੀ ਹੈ ਛੋਲੇ ਭਟੂਰੇ ਖਾਣਾ ਸੋ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਅਤੇ ਮੈਂ ਉੱਥੇ ਉਚੇਚਾ ਜਾਂਦੀ ਹਾਂ ਉਹ ਵਾਲੇ ਡਿਸ਼ ਟਰਾਈ ਕਰਨ ਵਾਸਤੇ